ਪੰਜਾਬ ਦੇ ਖੇਤਰ ਵਿੱਚ ਧਰਮ ਬਹੁਤ ਪ੍ਰਭਾਵ ਕਰਦਾ ਹੈ ਜਿਵੇਂ ਕਿ ਕਈ ਲੋਕ ਬਾਹਰੋਂ ਆਉਂਦੇ ਹਨ ਬਾਹਰਲੀਆਂ ਸਟੇਟਸ ਤੋਂ ਆਉਂਦੇ ਹਨ ਅੰਮ੍ਰਿਤਸਰ ਮੱਥਾ ਟੇਕਣ ਅੰਮ੍ਰਿਤਸਰ ਮੱਥਾ ਟੇਕਣ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਜਾਂ ਦੂਜੇ ਕਿਸੇ ਦੇ ਰਿਲੀਜਨ ਨੂੰ ਜਾਨਣ ਵਾਸਤੇ ਜਾਂ ਦੂਜੇ ਦੇ ਕਲਚਰ ਨੂੰ ਜਾਨਣ ਵਾਸਤੇ ਕਿ ਕੌਣ ਕਿਵੇਂ ਕੀ ਕਰਦਾ ਹੈ ਜਿਵੇਂ ਕਿ ਲੋਕ ਅੰਮ੍ਰਿਤਸਰ ਜਾਂਦੇ ਹਨ ਗੋਲਡਨ ਟੈਂਪਲ ਸਾਨੂੰ ਸਾਰਿਆਂ ਨੂੰ ਪਤਾ ਕਿ ਗੋਲਡਨ ਟੈਂਪਲ ਅੰਮ੍ਰਿਤਸਰ ਦੇ ਵਿੱਚ ਸਥਿੱਤ ਹੈ ਜਿੱਥੇ ਕਿ ਬਹੁਤ ਸਾਰੇ ਲੋਕ ਆਉਂਦੇ ਹਨ ਆਪਣੇ ਆਪਣੀਆਂ ਆਪਣੇ ਦੁੱਖ ਲੈ ਕੇ ਆਉਂਦੇ ਹਨ ਭਾਵੇਂ ਉੱਥੇ ਘੁੰਮਣ ਆਉਂਦੇ ਹਨ ਅਤੇ ਫਿਰ ਉਹਦੇ ਬਾਅਦ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਸ਼ਹੂਰ ਆ ਜਿਵੇਂ ਕਿ ਜੁੱਤੀਆਂ ਫੁਲਕਾਰੀਆਂ ਅਤੇ ਪੰਜਾਬ ਦੇ ਵਿੱਚ ਹੋਰ ਵੀ ਕਈ ਸਾਰੇ ਗੁਰਦੁਆਰੇ ਹਨ ਜਿਵੇਂ ਕਿ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਦਰਬਾਰ ਸਾਹਿਬ ਅਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਕਿ ਦੇਸ਼ ਭਰ ਤੋਂ ਲੋਕ ਆਉਂਦੇ ਹਾਂ ਜਿਵੇਂ ਕਿ ਦਿੱਲੀ ਹਿਮਾਚਲ ਨੈ ਨੈਨੀਤਾਲ ਹੋ ਅਸੀਂ ਹੋਰ ਵੀ ਕਿਤੇ ਅਪ ਟੂਰਿਸਟ ਟੂਰਿਜ਼ਮ ਨੂੰ ਵਧਾ ਸਕਦੇ ਹਾਂ ਅਤੇ ਹੁਣ ਜਿਵੇਂ ਕਿ ਕਈ ਲੋਕ ਗਰਮੀਆਂ ਦੇ ਵਿੱਚ ਹਿਲ ਸਟੇਸ਼ਨ 'ਤੇ ਚਲੇ ਜਾਂਦੇ ਹਨ ਘੁੰਮਣ ਵਾਸਤੇ ਜਾਂ ਫਿਰ ਕਿਤੇ ਕਿਤੇ ਕਿ ਗੋਆ ਚਲ ਜਾਂਦੇ ਹਨ ਘੁੰਮਣ ਵਾਸਤੇ ਜਿਹਦੇ ਕਰਕੇ ਕਿ ਸਾ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਉੱਥੇ ਦਿਆਂ ਨੂੰ ਅਤੇ ਜਿਹੜੇ ਲੋਕ ਆਏ ਹੁੰਦੇ ਆ ਯਾਤਰਾ ਕਰਨ ਲਈ ਉਹਨਾਂ ਨੂੰ ਸਮਝ ਆਉਂਦਾ ਕਿ ਇੱਥੋਂ ਦੇ ਲੋਕ ਕਿੱਦਾਂ ਦੇ ਆ ਕਿ ਉਹਨਾਂ ਦੇ ਕਲਚਰ ਬਾਰੇ ਪਤਾ ਲੱਗਦਾ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਪਤਾ ਲੱਗਦਾ ਹੈ ਕਿ ਉਹਨਾਂ ਦਾ ਖਾਂਦੇ ਕਿੱਦਾਂ ਉਹ ਪੀਂਦੇ ਕੀ ਹੈ ਪਾਉਂਦੇ ਕੀ ਹੈ